ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਹਾਂਜੀ ਮੈਮ ਗਿਆਨ ਸਾਗਰ ਹੌਸਪੀਟਲ ਤੋਂ ਬੋਲ ਰਿਹਾ ਜੀ

ਕੋਈ ਗੱਲ ਨਹੀਂ ਜਦੋਂ ਮਰਜੀ ਆ ਜਾਇਓ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਮਰਜੀ ਆ ਸਕਦੇ ਹੋ ਵੀਰੇ ਆਪਣੀਆਂ ਸਾਰੀਆਂ ਫੈਸਿਲਟੀਜ਼ ਅਵੇਲੇਬਲ ਨੇ ਹਾਂਜੀ ਲੈਬ ਟੈਕਨੀਸ਼ੀਅਨ ਵੀ ਹੈਗਾ ਸਕੈਨ ਅਲਟਰਾ ਸਾਊਂਡ ਐਮ ਆਰ ਆਈ ਹਰੇਕ ਤਰ੍ਹਾਂ ਦੀ ਫੈਸਿਲਟੀ ਆਪਣੇ ਕੋਲ ਅਵੇਲੇਬਲ ਹੈ ਕਾਬਲ ਡੋਕਟਰ ਨੇ ਗਿਆਨੀ ਡਿਪਾਰਟਮੈਂਟ ਅਲੱਗ ਹੈ ਹਾਂਜੀ ਸਰਜਨ ਵੀ ਹੈਗਾ ਯੁਰੋਲੋਜੀ ਦੇ ਡੋਕਟਰ ਵੀ ਅਲੱਗ ਨੇ ਹਾਂਜੀ ਹਾਂਜੀ ਉਹ ਡੋਕਟਰ ਦੇ ਪੇਟ ਦੇ ਵੀ ਆਪਣੇ ਕੋਲ ਆਉਂਦੇ ਨੇ ਬਹੁਤ ਅੱਛੇ ਡਾਕਟਰ ਨੇ ਕਾਬਿਲ ਡਾਕਟਰ ਨੇ ਉਹ ਲਗਭਗ ਤਮਿਲਨਾਡੂ ਤੋਂ ਆਪਾਂ ਹਾਇਰ ਕੀਤੇ ਹੋਏ ਨੇ ਡਾਕਟਰ ਇੱਥੇ ਅਤੇ ਚੌਵੀ ਘੰਟੇ ਫੈਸਿਲਟੀ ਅਵੇਲੇਬਲ ਹੈ ਚੌਵੀ ਘੰਟੇ ਡੋਕਟਰ ਸਾਹਿਬ ਆਪਣੇ ਕੋਲ ਹੁੰਦੇ ਹੈ ਤੁਸੀਂ ਜਦੋਂ ਮਰਜੀ ਆ ਸਕਦੇ ਹੋ ਸਕੈਨ ਵੀ ਹੋ ਜਾਏਗਾ ਸੀ ਟੀ ਸਕੈਨ ਅਲਟਰਾਸਾਊਂਡ ਐੱਮ ਆਰ ਆਈ ਹਰੇਕ ਤਰ੍ਹਾਂ ਦੀ ਫੈਸਿਲਟੀ ਆਪਣੇ ਕੋਲ ਅਵੇਲੇ ਹੈ ਆਪਣੀ ਅਵੇਲੇਬਲ ਹੈ ਹਰੇਕ ਪ੍ਰਕਾਰ ਦੇ ਡੋਕਟਰ ਆਪਣੇ ਕੋਲ ਅਵੇਲੇਬਲ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਵੇਗੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਪਣਾ ਹੈਲਥ ਚੈੱਕ ਕਰਵਾ ਸਕਦੇ ਹੋ ਬਾਈ ਦਾ ਵੇਅ ਤੁਹਾਨੂੰ ਦਿੱਕਤ ਕੀ ਆ ਰਹੀ ਵੈਸੇ ਪੇਟ ਦੇ ਵਿੱਚ ਓਕੇ ਜੀ

ਠੀਕ ਹੈ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਐਜ਼ੂਕੇਟਡ ਸਟਾਫ ਆ ਆਪਣੇ ਕੋਲ ਹਰੇਕ ਤਰ੍ਹਾਂ ਦੀ ਫੈਸਿਲਟੀ ਅਵੇਲੇਬਲ ਹੈ ਜ਼ਰੂਰਤ ਦੇ ਮੁਤਾਬਕ ਸਿਟੀ ਸਕੈਨ ਅਲਟਰਾਸਾਊਂਡ ਐੱਮ ਆਰ ਆਈ ਇਕੋਓਗਰਾਫੀ ਕਾਰਡੀਓਗਰਾਫੀ ਸਾਰੇ ਟੈਸਟ ਆਪਣੇ ਕੋਲ ਅਵੇਲੇਬਲ ਨੇ ਹਾਂਜੀ ਟਵੈਂਟੀ ਫੋਰਸ ਹਾਂਜੀ ਆਪਣੇ ਵੀਰੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਹਾਂਜੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਨੇੜੇ ਪਿੰਡ ਹੈਗਾ ਉਹਦੇ ਲਾਗੇ ਆ ਆਪਣਾ ਹੋਸਪਿਟਲ ਮਤਲਬ ਲੋਕੇਸ਼ਨ ਤੁਹਾਨੂੰ ਤੁਹਾਡਾ ਵਟਸਐਪ ਚੱਲਦਾ ਜੀ ਫਿਰ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਿੰਦਾ ਅਤੇ ਆਪਣੀ ਹੋਸਪਿਟਲ ਦੀ ਸਾਰੀ ਫੈਸਿਲਿਟੀ ਵੀ ਤੁਹਾਨੂੰ ਉਹ ਸੈਂਡ ਕਰ ਦਿੰਦਾ ਜੀ

ਜੀ ਹਾਂਜੀ ਫੀਜਓਥੈਰਪੀ ਵੀ ਅਵੇਲੇਬਲ ਹੈ ਆਪਣੇ ਕੋਲ ਹਾਂਜੀ ਫੀਜਓਥੈਰਪੀ ਵੀ ਅਵੇਲੇਬਲ ਹੈ ਕਾਰਡੀਓਗ੍ਰਾਫੀ ਵੀ ਮੋਮੋਗਰਾਫੀ ਵੀ ਹਰੇਕ ਤਰ੍ਹਾਂ ਦੀ ਫੈਸਿਲਟੀ ਅਵੇਲੇਬਲ ਹੈ ਜੀ ਮਲਟੀ ਸਪੈਸ਼ਲਿਸਟ ਹੌਸਪੀਟਲ ਹੈ ਆਪਣਾ ਇੱਕ ਹੁੰਦਾ ਸਪੈਸ਼ਲਿਸਟ ਆਪਣਾ ਮਲਟੀ ਸਪੈਸ਼ਲਿਸਟ ਹੈ ਹਰੇਕ ਤਰ੍ਹਾਂ ਦੀ ਹਾਰਟ ਦੇ ਡੋਕਟਰ ਕਿਡਨੀ ਦੇ ਡੋਕਟਰ ਯੁਰੂਲੋਜੀ ਦੇ ਡੋਕਟਰ ਮਤਲਬ ਕਿ ਹਰੇਕ ਤਰ੍ਹਾਂ ਡੋਕਟਰਸ ਅਵੇਲੇਬਲ ਨੇ ਚੌਵੀ ਘੰਟੇ ਅਵੇਲੇਬਲ ਨੇ ਹਾਂਜੀ ਇੱਦਾਂ ਨਹੀਂ ਕਿ ਤੁਹਾਨੂੰ ਕੋਈ ਰਾਤ ਨੂੰ ਜਾਂ ਦਿੱਕਤ ਆਵੇਗੀ ਜਾਂ ਬਾਈ ਦਾ ਵੇਅ ਤੁਸੀਂ ਜੇ ਰਾਤ ਨੂੰ ਵੀ ਆਉਂਦੇ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਣੇ ਕੋਲ ਚੌਵੀ ਘੰਟੇ ਹੀ ਅਵੇਲੇਬਲ ਹੈ ਐਬੂਲੈਂਸ ਦੀ ਵੀ ਸੁਵਿਧਾ ਆਪਣੇ ਕੋਲ ਚੌਵੀ ਘੰਟੇ ਅਵੇਲੇਬਲ ਹੈ ਜੇਕਰ ਤੁਹਾਨੂੰ ਬਾਈ ਦਾ ਵੇਅ ਕਿਤੇ ਰੈਫਰ ਵੀ ਕਰਨਾ ਪੈ ਜਾਂਦਾ ਚੌਵੀ ਘੰਟੇ ਐਬੂਲੈਂਸ ਵੀ ਅਵੇਲੇਬਲ ਹੈ ਆਪਣੇ ਕੋਲ

ਵੀਰੇ ਚੌਵੀ ਘੰਟੇ ਅਵੇਲੇਬਲ ਹੈ ਟਵੈਂਟੀ ਫੋਰ ਹਾਵਰ ਹੈ ਸਰਵਿਸ ਤੁਸੀਂ ਨੇਹਰੇ ਆਓ ਸਵੇਰੇ ਆਓ ਜਦੋਂ ਮਰਜੀ ਆ ਸਕਦੇ ਹੋ ਆਪਾਂ ਕੋਲ ਜਿੰਨੇ ਵੀ ਡੋਕਟਰ ਇੱਥੇ ਹੈਗੇ ਆ ਨਾ ਸਾਰੇ ਅਵੇਲੇਬਲ ਨੇ ਚੌਵੀ ਅ ਟਵੈਂਟੀ ਫੋਰ ਹਾਵਰ ਅਵੇਲੇਬਲ ਨੇ ਲੈਬ ਵੀ ਆਪਣੇ ਆਪ ਦੀ ਹੈ ਜੇਕਰ ਕਿਸੇ ਤਰ੍ਹਾਂ ਦੇ ਕੋਈ ਟੈਸਟ ਵਗੈਰਾ ਕਰਵਾਉਣੇ ਹੋਣਗੇ ਤਾਂ ਘੱਟੋ ਘੱਟ ਜ਼ਿਆਦਾ ਨਹੀਂ ਫਿਫਟੀ ਪਰਸੈਂਟ ਡਿਸਕਾਊਂਟ 'ਤੇ ਕੀਤੇ ਜਾਂਦੇ ਨੇ ਹਾਂਜੀ ਅਤੇ ਜਿਹੜੇ ਲੋਕਲ ਪੇਸ਼ੈਂਟ ਨੇ ਜਾਂ ਉਹਨਾਂ ਵਾਸਤੇ ਸ਼ਪੈਸ਼ਲ ਰਿਆਇਤ ਵੀ ਹੈਗੀ ਹੈ ਵੱਧ ਤੋਂ ਵੱਧ ਡਿਸਕਾਉਂਟ ਵੀ ਦਿੱਤਾ ਜਾਂਦਾ ਹੈ ਜਿੰਨਾ ਹੋ ਸਕੇ ਉਨ੍ਹਾਂ ਨੂੰ ਡਿਸਕਾਉਂਟ ਵੀ ਕੀਤਾ ਜਾਂਦਾ ਹੈ ਬਾਕੀ ਤੁਸੀਂ ਕੋਈ ਨਹੀਂ ਆਓ ਜਦੋਂ ਮਰਜ਼ੀ ਆਓ ਇੱਕ ਵਾਰ ਵਿਜਿਟ ਕਰੋ ਵਿਜਿਟ ਕਰਕੇ ਦੇਖੋ ਆ ਕੇ ਹੋਸਪਿਟਲ ਦੀ ਫਸਿਲਟੀਜ਼ ਹਾਂਜੀ ਨੀਟ ਐਂਡ ਕਲੀਨ ਐਂਡ ਗਰੀਨ ਹੈ ਜਿਵੇਂ ਮਰਜ਼ੀ ਆ ਸਕਦੇ ਬਾਈ ਦਾ ਵੇ ਆਪਾਂ ਕਿੱਥੋਂ ਬੋਲਦੇ ਪਏ ਹਾਂ ਜੀ ਅੱਛਾ ਫਿਰੋਜ਼ਪੁਰ ਤੋਂ ਬੋਲ ਰਹੇ ਹੋ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਸਕਦੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਥੈਂਕ ਯੂ ਵੈਲਕਮ